ਸਾਡੇ ਖੇਤਰ ਦੇ ਵਿੱਚ ਅੰਤਰ ਭਾਈਚਾਰਕ ਲੜਾਈਆਂ ਚਾਹੇ ਬਹੁਤ ਘੱਟ ਹੋਈਆਂ ਨੇ ਪਰ ਸਾਡੇ ਖੇਤਰ ਦੇ ਵਿੱਚ ਇਤਿਹਾਸਿਕ ਲੜਾਈਆਂ ਮੋਰਚੇ ਇਸ ਤਰ੍ਹਾਂ ਦੀ ਜਿਹੜੀਆਂ ਘਟਨਾਵਾਂ ਨੇ ਉਹ ਕਾਫ਼ੀ ਹੋਈਆਂ ਨੇ ਜਿਹਦੇ ਵਿੱਚ ਚਾਬੀਆਂ ਦਾ ਮੋਰਚਾ ਜੋ ਕਿ ਸਾਰੇ ਪੰਜਾਬ ਦੇ ਵਿੱਚ ਚੱਲਿਆ ਸੀ ਇੱਥੋਂ ਦੇ ਗੁਰਦੁਆਰਾ ਪ੍ਰਬੰਧਾਂ ਦਾ ਜਿਹੜਾ ਰੌਲਾ ਸੀ ਉਹ ਕਾਫ਼ੀ ਸੀਗਾ ਜਿਹਦੇ ਵਿੱਚ ਸਾਡੇ ਗੁਰੂ ਘਰਾਂ ਦੇ ਉੱਤੇ ਮਹੰਤਾਂ ਨੇ ਕਬਜਾ ਕਰ ਲਿਆ ਸੀ ਅਤੇ ਉਨ੍ਹਾਂ ਦੀਆਂ ਜਿਹੜੀਆਂ ਚਾਬੀਆਂ ਸੀਗੀਆਂ ਉਹ ਆਪਣੇ ਕੋਲੇ ਰੱਖ ਲਈਆਂ ਸੀ ਤੇ ਐੱਸ ਜੀ ਪੀ ਸੀ ਨੇ ਉਹ ਚਾਬੀਆਂ ਨੂੰ ਛਡਾਉਣ ਦੇ ਲਈ ਬਹੁਤ ਸਾਰੇ ਯਤਨ ਕੀਤੇ ਸੀ ਜਿਹਦੇ ਵਿੱਚ ਉਨ੍ਹਾਂ ਨੇ ਮਹੰਤਾਂ ਪ੍ਰਤੀ ਵਿਦਰੋਹ ਕੀਤੇ ਤੇ ਉਨ੍ਹਾਂ ਵਿਚਕਾਰ ਲੜਾਈਆਂ ਵੀ ਹੋਈਆਂ ਕਈ ਨਿਹੰਗ ਮਾਰੇ ਵੀ ਗਏ ਸੀਗੇ ਕਈ ਸਿੱਖਾਂ ਨੂੰ ਜਿਉਂਦਾ ਵੀ ਸਾੜਿਆ ਗਿਆ ਸੀਗਾ ਜਿਹਦੇ ਵਿੱਚ ਲੋਕਾਂ ਨੇ ਬਹੁਤ ਸਾਰਾ ਵਿਦਰੋਹ ਕੀਤਾ ਤੇ ਉਹ ਚਾਬੀਆਂ ਵਾਪਸ ਲੈਣ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਜਿਹੜੇ ਅੰਦੋਲਨ ਸੀਗੇ ਉਹ ਚਲਾਏ ਗਏ ਸੀਗੇ ਐਥੋਂ ਦੇ ਜਿਹੜੇ ਆਪਣੇ ਗੁਰਦੁਆਰਾ ਸਾਬ ਨੇ ਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਨੇ ਗੇ ਇਹ ਬਹੁਤ ਪ੍ਰਾਚੀਨ ਗੁਰਦੁਆਰਾ ਸਾਹਿਬ ਨੇ ਜਿਹਦੇ ਵਿੱਚ ਪਹਿਲਾਂ ਮਹੰਤਾਂ ਦਾ ਕਬਜਾ ਹੁੰਦਾ ਸੀਗਾ ਮਹੰਤਾਂ ਨੇ ਇਸ ਗੁਰਦੁਆਰਾ ਸਾਹਿਬ ਉੱਤੇ ਕਬਜਾ ਕਰ ਲਿਆ ਸੀਗਾ ਆਪਣੀਆਂ ਚਾਬੀਆਂ ਆਪਣੇ ਕੋਲ ਰੱਖ ਲਈਆਂ ਸੀਗੀਆਂ ਜਿਹਦੇ ਵਿੱਚ ਉਨ੍ਹਾਂ ਨੇ ਗੁਰੂ ਘਰਾਂ ਨੂੰ ਬੇਅਦਬੀ ਕਰਨਾ ਗੁਰੂ ਘਰਾਂ ਦੇ ਵਿੱਚ ਮਾਸ ਮੀਟ ਖਾਣਾ ਗੁਰੂ ਘਰਾਂ ਦੇ ਵਿੱਚ ਨਾਚ ਕਰਵਾਉਣੇ ਇਸ ਤਰਾਂ ਦੀਆਂ ਗਤੀਵਿਧੀਆਂ ਉਹ ਕਰਨ ਲੱਗ ਗਏ ਸੀਗੇ ਜਿਹਦੇ ਵਿੱਚ ਸਾਡੇ ਗੁਰਸਿੱਖ ਭਾਈ ਭਾਈਚਾਰੇ ਨੇ ਬਹੁਤ ਸਾਰਾ ਸੰਘਰਸ਼ ਕੀਤਾ ਤੇ ਉਨ੍ਹਾਂ ਨੇ ਮਹੰਤਾਂ ਪ੍ਰਤੀ ਵਿਦਰੋਹ ਕੀਤੇ ਤੇ ਕਈ ਲੜਾਈਆਂ ਵੀ ਹੋਈਆਂ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਮਾਰੇ ਗਏ ਸੀ ਸਿੱਖਾਂ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਗੁਰਦੁਆਰਾ ਸਹਿਬ ਨੂੰ ਅਜਾਦ ਕਰਵਾਇਆ ਅਤੇ ਅੱਜ ਇਹ ਗੁਰਦੁਆਰਾ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ ਇੱਥੇ ਲੋਕ ਬਹੁਤ ਮਹਾਨਤਾ ਦੇ ਨਾਲ ਸਤਿਕਾਰ ਦੇ ਨਾਲ ਨਮਨ ਹੁੰਦੇ ਹਨ ਬਾਕੀ ਗੱਲ ਮੈਂ ਰੇਲਾਂ ਬਾਰੇ ਗੱਲ ਕਰਨਾ ਚਾਹਾਂਗਾ ਜਿਹਦੇ ਵਿੱਚ ਸਾਡੇ ਕਿਸਾਨ ਮੋਰਚੇ ਲੱਗੇ ਨੇ ਸਾਡੇ ਨੇੜੇ ਪਿੰਡ ਜੇਠੂ ਕੇ ਜਿਹਦੇ ਵਿੱਚ ਕਿਸਾਨਾਂ ਨੇ ਰੇਲਾਂ ਰੋਕ ਕੇ ਸਰਕਾਰ ਪ੍ਰਤੀ ਆਪਣਾ ਵਿਦਰੋਹ ਕੀਤਾ ਸੀਗਾ ਤਾਂ ਇਹ ਇਹ ਸਾਰੀਆਂ ਗੱਲਾਂ ਇਹ ਸਾਰੀਆਂ ਘਟਨਾਵਾਂ ਸਾਡੇ ਸਾਡੇ ਜਿਲ੍ਹੇ ਦੇ ਨਾਲ ਸਬੰਧਿਤ ਨੇ ਗੀਆਂ ਸਾਡੇ ਏਰੀਏ ਦੇ ਨਾਲ ਸਬੰਧਿਤ ਨੇ ਗੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ